ਮੈਨੂੰ ਇਟੈਲੀਅਨ ਪਾਸਤਾ ਬਹੁਤ ਪਸੰਦ ਹੈ ਪਰ ਹਰ ਵਾਰ ਮੈਂ ਬਾਹਰੋਂ ਮੰਗਵਾਉਣਾ ਚਾ ਮੰਗਵਾਉਂਦੀ ਸੀ ਪਰ ਇਸ ਵਾਰ ਮੈਂ ਬਾਹਰੋਂ ਨਹੀਂ ਮੰਗਵਾਉਣਾ ਚਾਹੁੰਦੀ ਸੀ ਕਿਉਂਕਿ ਇਹ ਬਹੁਤ ਕੋਸਟਲੀ ਪੈਂਦਾ ਹੈ ਇਸ ਲਈ ਮੈਂ ਘਰੇ ਬਣਾਉਣ ਬਾਰੇ ਸੋਚਿਆ ਮੈਂ ਪਾਸਤਾ ਦੀ ਰੇਸਪੀ ਯੂਟਿਊਬ 'ਤੇ ਦੇਖੀ ਮੈਨੂੰ ਬਹੁਤ ਈਜੀ ਲੱਗੀ ਪਰ ਜਦੋਂ ਮੈਂ ਬਣਾਉਣ ਲੱਗੀ ਤਾਂ ਇਹ ਬਹੁਤ ਚੁਣੌਤੀਪੂਰਨ ਵਿਅੰਜਨ ਸੀ ਇਸ ਵਿੱਚ ਇਸ ਤਰ੍ਹਾਂ ਦੇ ਇੰਗਰੀਡੀਐਂਟਸ ਯੂਸ ਹੁੰਦੇ ਜੋ ਮੈਨੂੰ ਪਤਾ ਵੀ ਨਹੀਂ ਸੀ ਜੋ ਕਿ ਮਾਰਕੀਟ 'ਤੇ ਮਸਾਂ ਮਿਲ ਮਿਲੇ ਕੁਛ ਸਮਾਨ ਤਾਂ ਮੈਨੂੰ ਮਿਲਿਆ ਨਹੀਂ ਜੋ ਕਿ ਮੈਂ ਔਨਲਾਈਨ ਓਡਰ ਕੀਤਾ ਇਸ ਨੂੰ ਬਣਾਉਣ 'ਤੇ ਬਹੁਤ ਟਾਈਮ ਵੇਸਟ ਹੋਇਆ ਜਿਸ ਕਰਕੇ ਮੈਨੂੰ ਬਹੁਤ ਦਿੱਕਤ ਹੋਈ ਇਸ ਨੂੰ ਬਣਾਉਣ ਵਿੱਚ ਮੈਨੂੰ ਤਿੰਨ ਚਾਰ ਘੰਟੇ ਲੱਗੇ ਜਿਸ ਕਾਰਨ ਮੈਂ ਹੋਰ ਕੋਈ ਕੰਮ ਵੀ ਨਹੀਂ ਕਰ ਸਕੀ ਸਭ ਪਰ ਹੁਣ ਦੋ ਤਿੰਨ ਵਾਰ ਬਣਾਉਣ ਨਾਲ ਇਸ ਨੂੰ ਬਣਾਉਣਾ ਅਸਾਨ ਲੱਗਦਾ ਹੈ ਅਤੇ ਹੁਣ ਮੈਂ ਹਫਤੇ ਵਿੱਚ ਇੱਕ ਵਾਰ ਬਣਾਉਂਦੀ ਹਾਂ ਪਰ ਜਦੋਂ ਮੈਂ ਪਹਿਲੀ ਵਾਰ ਟਰਾਈ ਕੀਤਾ ਸੀ ਉਦੋਂ ਮੈਨੂੰ ਬਹੁਤ ਦਿੱਕਤ ਹੋਈ ਕਿਉਂਕਿ ਮੈਂ ਇਹ ਯੂਟਿਊਬ ਤੋਂ ਵੇਖ ਕੇ ਬਣਾਇਆ ਯੂਟਿਊਬ 'ਤੇ ਤਾਂ ਬਹੁਤ ਸੌਖਾ ਦੱਸਿਆ ਗਿਆ ਸੀ ਪਰ ਜਦੋਂ ਮੈਂ ਇਹਨੂੰ ਬਣਉਣ ਲੱਗੀ ਤਾਂ ਮੈਨੂੰ ਬਹੁਤ ਹੀ ਦਿੱਕਤ ਹੋਈ ਪਹਿਲਾਂ ਤਾਂ ਮੈਨੂੰ ਸਮਾਨ ਹੀ ਨਹੀਂ ਮਿਲਿਆ ਜੇ ਜਦੋਂ ਸਮਾਨ ਮਿਲਿਆ ਤਾਂ ਕਈ ਇਸ ਤਰ੍ਹਾਂ ਦਾ ਸੀ ਜਿਹੜੇ ਮੈਂ ਕਦੀ ਯੂਸ ਹੀ ਨਹੀਂ ਕੀਤੇ ਸੀ ਤਾਂ ਮੈਨੂੰ ਉਨ੍ਹਾਂ ਦੇ ਯੂਸ ਅਤੇ ਉਨ੍ਹਾਂ ਦੇ ਹੈਲਥ ਰਿਲੇਟਿਡ ਬਾਰੇ ਇਸ਼ੂਸ ਬਾਰੇ ਪਤਾ ਕਰਨਾ ਪਿਆ ਤਾਂ ਫਿਰ ਜਾ ਕੇ ਮੈਂ ਇਸ ਨੂੰ ਤਿਆਰ ਕੀਤਾ ਅਤੇ ਫਿਰ ਮੈਨੂੰ ਹੁਣ ਬਹੁਤ ਹੀ ਵਧੀਆ ਲੱਗਦਾ ਹੈ ਇਹ ਬਣਾਉਣਾ